ਹਾਂ ਮੈਨੂੰ ਬਹੁਤ ਵਾਰੀ ਮਤਲਬ ਕਿ ਗੂਗਲ 'ਤੇ ਕਈ ਵਾਰ ਸਰਚ ਕਰਦੇ ਹਾਂ ਉਹਦੇ 'ਚ ਜ਼ਿਆਦਾਤਰ ਇੰਗਲਿਸ਼ ਆਉਂਦੀ ਆ ਉਹ ਫਿਰ ਮੈਨੂੰ ਪੰਜਾਬੀ ਦੇ ਵਿੱਚ ਟ੍ਰਾਂਸਲੇਟ ਕਰਕੇ ਦੇਖਣਾ ਪੈਂਦਾ ਕਿਉਂਕਿ ਮੇਰੇ ਫੋਨ ਦੇ ਵਿੱਚ ਵੀ ਪੰਜਾਬੀ ਆ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੇ ਮੈਨੂੰ ਇੰਗਲਿਸ਼ ਦੇ ਵਿੱਚ ਮਿਲਦੀਆਂ ਨੇ ਉਹਨਾਂ ਨੂੰ ਮੈਂ ਪੰਜਾਬੀ ਦੇ ਵਿੱਚ ਟ੍ਰਾਂਸਲੇਟ ਕਰਕੇ ਦੇਖਦਾ ਅਤੇ ਮੈਨੂੰ ਬਹੁਤ ਵਧੀਆ ਲੱਗਦਾ ਬਹੁਤ ਵਾਰੀ ਮੇਰੇ ਨਾਲ ਹੋਇਆ ਅਤੇ ਮੈਂ ਫੋਨ ਦੀ ਜਿਹੜੀ ਵਰਤੋਂ ਨਾ ਉਹ ਵੀ ਪੰਜਾਬੀ 'ਚ ਕਰਦਾ ਸਾਰੇ ਇਹਦੀ ਜਿਹੜੀ ਭਾਸ਼ਾ ਉਹ ਵੀ ਪੰਜਾਬੀ 'ਚ ਕਰੀ ਹੋਈ ਮੇਰੀ ਸਾਰੀ ਭਾਸ਼ਾ ਆ ਜਿੰਨੀ ਫੋਨ ਦੇ ਵਿੱਚ ਹੈ ਅਤੇ ਬਹੁਤ ਵਾਰੀ ਮੇਰੇ ਨਾਲ ਇੱਦਾਂ ਦਾ ਹੁੰਦਾ ਕਈ ਵਾਰੀ ਕੋਈ ਇੱਦਾਂ ਦੀ ਇੰਗਲਿਸ਼ ਵਿੱਚ ਬੁੱਕ ਮਿਲ ਜਾ ਉਹਨੂੰ ਫਿਰ ਮੈਂ ਪੰਜਾਬੀ ਵਿੱਚ ਟ੍ਰਾਂਸਲੇਟ ਕਰਕੇ ਵੇਖਦਾ ਅਤੇ ਮੈਨੂੰ ਬਹੁਤ ਸ਼ੌਂਕ ਹੈ ਵੀ ਨਾ ਅਤੇ ਪੰਜਾਬੀ ਦਾ ਅਤੇ ਕਿਉਂਕਿ ਕਈ ਵਾਰੀ ਹਿੰਦੀ ਵੀ ਆ ਜਾਂਦੀ ਆ ਉਹਨੂੰ ਵੀ ਮੈਨੂੰ ਪੰਜਾਬੀ ਦੇ ਵਿੱਚ ਟ੍ਰਾਂਸਲੇਟ ਕਰਕੇ ਵੇਖਣਾ ਪੈਂਦਾ ਬਹੁਤ ਵਾਰੀ ਕਿਉਂਕਿ ਇੰਗਲਿਸ਼ ਦੇ ਵਿੱਚ ਮੈਨੂੰ ਬਹੁਤ ਸਾਰੀ ਦਿੱਕਤ ਆਉਂਦੀ ਰਹਿੰਦੀ ਹੈ ਫਿਰ ਮੈਨੂੰ ਇਹ ਸਮਝ ਆ ਜਾਂਦੀ ਜਦੋਂ ਮੈਂ ਇੰਗਲਿਸ਼ 'ਤੇ ਟ੍ਰਾਂਸਲੇਟ ਕਰਕੇ ਪੰਜਾਬੀ 'ਚ ਵੇਖਦਾ ਧੰਨਵਾਦ